ਮੈਂ ਤੁਹਾਡੀ ਕੰਪਨੀ ਤੋਂ ਇਕ ਔਨਲਾਈਨ ਆਰਡਰ ਕੀਤਾ ਸੀ ਜੋ ਕਿ ਬਹੁਤ ਹੀ ਲੇਟ ਪੁੱਜਿਆ ਸੀ ਅਤੇ ਜਦੋਂ ਮੈਂ ਪਾਰਸਲ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਇੱਕ ਕੁੜਤਾ ਸੀ ਅਤੇ ਕੁੜਤੇ ਨੂੰ ਦੇਖ ਕੇ ਮੇਰਾ ਮਨ ਬਹੁਤ ਦੁਖੀ ਹੋਇਆ ਕਿਉਂਕਿ ਜਿਸ ਤਰ੍ਹਾਂ ਪਿਕਚਰ ਵਿੱਚ ਕੁੜਤਾ ਦੱਸਿਆ ਹੋਇਆ ਸੀ ਉਸ ਤਰ੍ਹਾਂ ਬਿਲਕੁਲ ਵੀ ਨਹੀਂ ਸੀ ਅਤੇ ਉਸ ਦਾ ਕਲਰ ਵੀ ਪਿਕਚਰ ਨਾਲੋਂ ਲਾਈਟ ਸੀ ਅਤੇ ਜਦੋਂ ਮੈਂ ਪਾ ਕੇ ਦੇਖਿਆ ਤਾਂ ਉਸਦੀ ਫਿਟਿੰਗ ਵੀ ਲੂਜ਼ ਸੀ ਅਤੇ ਉਹਦੇ ਵਿੱਚ ਟੁੱਕ ਲੱਗੀ ਹੋਈ ਸੀ ਅਤੇ ਦੋ ਤਿੰਨ ਵਾਰ ਧੋਣ ਤੋਂ ਬਾਅਦ ਕੁੜਤੇ ਦਾ ਕਲਰ ਵੀ ਫੇਡ ਹੋ ਗਿਆ ਇਸ ਕਰਕੇ ਮੇਰਾ ਮਨ ਬਹੁਤ ਦੁੱਖੀ ਹੋਇਆ ਕਿਰਪਾ ਕਰਕੇ ਮੇਰਾ ਆਰਡਰ ਮੇਰਾ ਆਰਡਰ ਮੇਰਾ ਆਰਡਰ ਰਿਫੰਡ ਕੀਤਾ ਜਾਵੇ ਔਨਲਾਈਨ ਪੇਮੈਂਟ ਮੈਂ ਕਰ ਦਿੱਤੀ ਮੈਂ ਔਨਲਾਈਨ ਪੇਮੈਂਟ ਕਰ ਚੁੱਕੀ ਹਾਂ ਕਿਰਪਾ ਕਰਕੇ ਮੈਨੂੰ ਰਿਫੰਡ ਕੀਤਾ ਜਾਵੇ ਧੰਨਵਾਦ